ਸਾਡੇ ਪਿੰਡਾਂ ਦੇ ਖੇਤਰ ਵਿੱਚ ਵੀ ਆਸ ਪਾਸ ਕਾਫੀ ਹਸਪਤਾਲ ਹਨ ਸਾਡੀ ਤਹਿਸੀਲ ਤਰਨ ਤਾਰਨ ਵਿੱਚ ਵੀ ਬਹੁਤ ਸਾਰੇ ਹਸਪਤਾਲ ਹਨ ਜਿੱਥੇ ਕਾਫੀ ਸਾਰੀਆਂ ਸਹੂਲਤਾਂ ਹਨ ਜਿਵੇਂ ਕਿ ਐਕਸਰੇ ਸਿਟੀ ਸਕੈਨ ਅਤੇ ਐਮ ਆਰ ਆਈ ਸਕੈਨ ਲਈ ਉਨੱਤ ਟੂਲ ਮੌਜੂਦ ਹਨ ਇਹ ਮਸ਼ੀਨਾਂ ਬਹੁਤ ਵਧੀਆ ਢੰਗ ਨਾਲ ਕੰਮ ਕਰਦੀਆਂ ਹਨ ਕੁਝ ਮਸ਼ੀਨਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਈਆਂ ਗਈਆਂ ਹਨ ਅਤੇ ਇਹ ਮਸ਼ੀਨਾਂ ਸਹੀ ਰਿਪੋਰਟਾਂ ਦਿੰਦੀਆਂ ਹਨ ਡਾਕਟਰ ਜੋ ਵੀ ਟੈਸਟ ਸਾਨੂੰ ਲਿਖ ਕੇ ਦਿੰਦੇ ਹਨ ਉਹ ਸਾਰੇ ਟੈਸਟ ਇੱਥੇ ਮੌਜੂਦ ਹਨ ਅਸੀਂ ਬਹੁਤ ਹੀ ਆਸਾਨੀ ਨਾਲ ਇਹ ਟੈਸਟ ਕਰਵਾ ਸਕਦੇ ਹਾਂ ਸਾਨੂੰ ਆਪਣੇ ਖੇਤਰ ਤੋਂ ਦੂਰ ਕਿਤੇ ਸ਼ਹਿਰ ਵੱਲ ਨਹੀਂ ਜਾਣਾ ਪੈਂਦਾ ਇਸ ਨਾਲ ਸਾਡੇ ਸਮੇਂ ਦੀ ਕਾਫੀ ਬੱਚਤ ਹੁੰਦੀ ਹੈ ਅਤੇ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਕੀਤਾ ਜਾਂਦਾ ਹੈ